ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨੇਹਾ ਐਮ ਸੀ ਬੋਲਦੀ ਹਾਂ ਜੀ

ਹਾਂਜੀ

ਹਾਂਜੀ ਹਾਂਜੀ ਦੱਸੋ ਜੀ ਅਸੀਂ ਜੀ ਹੋਰ ਵਾਰਡ ਨੰਬਰਾਂ 'ਚ ਜਾ ਰਹੇ ਹਾਂ ਜੀ ਤੁਹਾਡਾ ਵਾਰਡ ਨੰਬਰ 'ਚ ਵੀ ਅਸੀਂ ਸਫਾਈ ਵਗੈਰਾ ਕਰਵਾਵਾਂਗੇ ਜੀ ਅਤੇ ਹੋਰ ਦੱਸੋ ਕੋਈ ਪ੍ਰੋਬਲਮ ਆ ਜੀ ਤੁਹਾਨੂੰ ਹਾਂਜੀ ਕੋਈ ਗੱਲ ਨਹੀਂ ਜੀ ਬਸ ਥੋੜ੍ਹਾ ਜਿਹਾ ਅਸੀਂ ਹੋਰ ਵਾਰਡ 'ਚ ਕੰਮ ਕਰ ਰਹੇ ਸੀ ਜੀ ਉਹ ਕੰਮ ਕੰਪਲੀਟ ਕਰਕੇ ਅਤੇ ਅਸੀਂ ਤੁਹਾਡੀ ਵਾਰਡ 'ਚ ਆਵਾਂਗੇ ਤੁਹਾਡਾ ਵਾਰਡ ਕਿਹੜਾ ਨੰਬਰ ਬੋਲਿਆ ਸੀ ਤੁਸੀਂ ਜੀ ਓਕੇ ਜੀ ਪੰਜ ਵਾਰਡ ਨੰਬਰ ਵਿੱਚ ਅਸੀਂ ਆਵਾਂਗੇ ਜੀ ਅਤੇ ਤੁਹਾਡੀ ਸਮੱਸਿਆ ਹੱਲ ਕਰਾਂਗੇ ਜੀ ਹਾਂਜੀ ਕੋਈ ਗੱਲ ਨਹੀਂ ਸਾਡਾ ਕੰਮ ਹੀ ਵੋਟਾਂ ਲੈਣਾ ਤੁਹਾਡੇ ਤੋਂ ਜੀ ਜ਼ਰੂਰ ਕੰਮ ਕਰਾਂਗੇ ਤੁਹਾਡਾ ਕੋਈ ਗੱਲ ਨਹੀਂ ਜੀ ਜ਼ਰੂਰ ਕਰਾਂਗੇ ਤੁਹਾਡਾ ਕੰਮ ਜੀ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੀ ਤੁਹਾਡੀ ਬੇਨਤੀ ਹੈ ਜੀ ਸੁਣਦੇ ਹਾਂ ਜ਼ਰੂਰ ਤੁਹਾਡੀ ਸਮੱਸਿਆ ਹੱਲ ਕਰਾਂਗੇ ਜੀ ਅਸੀਂ ਬਿਲਕੁਲ ਸਵੱਛ ਵਧੀਆ ਸੜਕਾਂ ਬਣਾ ਦਾਂਗੇ ਜੀ ਵਧੀਆ ਸੁੰਦਰ ਲੱਗਣਗੀਆਂ ਸੜਕਾਂ ਤੁਹਾਡੀਆਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਭ ਕੁਛ ਸਹੀ ਕਰਵਾਵਾਂਗੇ ਜੀ ਹਾਂਜੀ ਬਿਲਕੁਲ ਕੂੜੇਦਾਨ ਦਾ ਸਾਰਾ ਪ੍ਰਬੰਧ ਕਰਵਾਵਾਂਗੇ ਜੀ ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ